ਸਤਿ ਸ਼੍ਰੀ ਅਕਾਲ ਜੀ ਮਨਜੀਤ ਟੈਕਸੀ ਤੋਂ ਬੋਲਦੇ ਹੋ ਇੱਕ ਮੈਂ ਟੈਕਸੀ ਬੁੱਕ ਕਰਵਾਉਣੀ ਸੀ ਮੇਰੇ ਭਰਾ ਨੇ ਕੈਨੇਡਾ ਵਾਸਤੇ ਜਾਣਾ ਹੈ ਅਤੇ ਉੱਥੇ ਅਸੀਂ ਚੰਡੀਗੜ੍ਹ ਤੋਂ ਦਿੱਲੀ ਜਾਣਾ ਹੈ ਪਰਸੋਂ ਨੂੰ ਮਿਤੀ ਤੇਰਾਂ ਜੁਲਾਈ ਦੋ ਹਜ਼ਾਰ ਤੇਈ ਸਵੇਰੇ ਚਾਰ ਵਜੇ ਨਿਕਲਣਾ ਹੈ ਅਤੇ ਰਸਤੇ ਵਿੱਚ ਅਸੀਂ ਭੋਜਨ ਖਾਣੇ ਭੋਜਨ ਵੀ ਖਾਣਾ ਹੈ ਅਤੇ ਅਸੀਂ ਰਸਤੇ ਵਿੱਚੋਂ ਦੋ ਰਿਸ਼ਤੇਦਾਰਾਂ ਨੂੰ ਚੱਕਣਾ ਹੈ ਸੋ ਅਸੀਂ ਕੁੱਲ ਮਿਲਾ ਕੇ ਛੇ ਸੱਤ ਬੰਦੇ ਹੋਣਗੇ ਸਾਨੂੰ ਉਸਦਾ ਰੇਟ ਦੱਸੋ ਅਤੇ ਸਾਨੂੰ ਸਮੇਂ ਸਿਰ ਪਹੁੰਚਾ ਦਿਉ ਧੰਨਵਾਦ ਜੀ